ਦਸ ਦਸੰਬਰ ਦੋ ਹਜ਼ਾਰ ਅਠਾਰਾਂ ਗਿਆਰਾਂ ਜਨਵਰੀ ਦੋ ਹਜ਼ਾਰ ਇੱਕੀ ਪੰਜ ਜੁਲਾਈ ਦੋ ਹਜ਼ਾਰ ਵੀਹ ਸੱਤ ਅਗਸਤ ਦੋ ਹਜ਼ਾਰ ਬਾਈ ਸੱਤ ਸਤੰਬਰ ਦੋ ਹਜ਼ਾਰ ਇੱਕੀ